ਮੈਨੂੰ ਬੁਣਾਈ ਤਾਂ ਬਹੁਤ ਸ਼ੌਂਕ ਹੈ ਅਤੇ ਮੈਨੂੰ ਇਸ ਦੀ ਲੋੜ ਵੀ ਹੈ ਕਿਉਂਕਿ ਮੇਰੇ ਕੋਲ ਇਸ ਤੋਂ ਇਲਾਵਾ ਕੋਈ ਸਾਧਨ ਨਹੀਂ ਅਤੇ ਮੈਂ ਸਿਲਾਈ ਜਾ ਕੋਈ ਵੀ ਆਪਣੇ ਇੱਛਾ ਕਰਕੇ ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋਣੇ ਚਾਹੀਦੀ ਅਤੇ ਮੈਨੂੰ ਇਸ ਦੇ ਨਾਲ ਆਪਣੇ ਘਰ ਦੇ ਵਿੱਚ ਵੀ ਕਾਫ਼ੀ ਸਹਿਯੋਗ ਮਿਲ ਰਿਹਾ ਅਤੇ ਆਪਣੇ ਪੈਰਾਂ 'ਤੇ ਵੀ ਸਟੈਂਡ ਹੋਣਾ ਚਾਹੁੰਦੀ ਹੈ ਅਤੇ ਉਸ ਤੋਂ ਬਾਅਦ ਮੈਂ ਅੜੋਸ ਪੜੋਸ ਦੇ ਵਿੱਚ ਵੀ ਚਾਹੁੰਦੀ ਹਾਂ ਕਿ ਮੈਂ ਆਪਣੇ ਪੈਰਾਂ 'ਤੇ ਸਟੈਂਡ ਹੋਵਾਂ ਅਤੇ ਨਾਲੇ ਆਪਣੇ ਨਾਲ ਜਿਹੜੇ ਮੇਰੀ ਸਹੇਲੀਆਂ ਜਾਂ ਕੋਈ ਹੋਰ ਮੇਰੇ ਨਾਲ ਕੰਮ ਕਰਨਾ ਚਾਹੁੰਦਾ ਹੈ ਉਹ ਵੀ ਮੇਰੇ ਨਾਲ ਲੱਗ ਕੇ ਇਸ ਕੰਮ ਨੂੰ ਅੱਗੇ ਵਧੇ ਅਤੇ ਆਪਣੇ ਪੈਰਾਂ 'ਤੇ ਸਟੈਂਡ ਹੋਵੇ ਅਤੇ ਕਿਸੇ ਦੇ ਅੱਗੇ ਹੱਥ ਫੈਲਾਉਣ ਦੀ ਲੋੜ ਕਿਸੇ ਨੂੰ ਵੀ ਨਾ ਪਵੇ ਕਿਉਂਕਿ ਹਰ ਕਿਸੇ ਦੀ ਆਪਣੀ ਆਪਣੀ ਮਜਬੂਰੀ ਹੁੰਦੀ ਹੈ ਹਰ ਕੋਈ ਇਨਸਾਨ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਵੇ ਆਪਣੀ ਇੱਛਾ ਮੁਤਾਬਿਕ ਕੰਮ ਕਰੇ ਅਤੇ ਆਪਣੀ ਲੋੜ ਪੂਰਾ ਕਰੇ ਅਤੇ ਸਭ ਤੋਂ ਅੱਛਾ ਇਹ ਹੈ ਕਿ ਇਨਸਾਨ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਵੇ ਬਹੁਤ ਅੱਛਾ ਹੈ ਅਤੇ ਆਪਣੇ ਹਰ ਇੱਛਾ ਪੂਰੀ ਕਰ ਲਵੇ